ਮੈਂ ਇੱਕ ਬਾਟਾ ਕੰਪਨੀ ਦੀ ਚੱਪਲ ਦਾ ਆਡਰ ਐਮੇਜ਼ਨ 'ਤੇ ਕੀਤਾ ਸੀ ਫਿਰ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਉਸ ਦੀ ਖੋਜ ਕੀਤੀ ਫਲਿੱਪਕਾਰਟ 'ਤੇ ਮੈਨੂੰ ਫਲਿੱਪਕਾਰਟ ਦੇ ਵਿੱਚ ਉਹ ਸੇਮ ਚੱਪਲ ਬਹੁਤ ਸਸਤੀ ਪਈ ਅਤੇ ਮੈਂ ਫਿਰ ਐਮੇਜ਼ੋਨ ਦੇ ਉੱਤੇ ਜਾ ਕੇ ਇਸ ਨੂੰ ਰੱਦ ਕਰ ਦਿੱਤਾ ਜਦੋਂ ਉਨ੍ਹਾਂ ਨੇ ਰੱਦ ਕਰਨ ਦਾ ਕਾਰਨ ਪੁੱਛਿਆ ਮੇਰੇ ਤੋਂ ਤੋ ਮੈਂ ਉਨ੍ਹਾਂ ਨੂੰ ਉਸ ਦੇ ਵਿੱਚ ਸਪੱਸ਼ਟੀਕਰਨ ਦਿੱਤਾ ਕਿ ਇਸ ਦਾ ਰੇਟ ਫਲਿੱਪਕਾਰਟ 'ਤੇ ਬਹੁਤ ਘੱਟ ਹੈ ਅਤੇ ਮੈਂ ਉਸ ਨੂੰ ਰੱਦ ਕਰ ਦਿੱਤਾ ਅਤੇ ਮੈਂ ਨਵਾਂ ਆਡਰ ਫਲਿੱਪਕਾਰਟ ਦੇ ਉੱਤੇ ਕਰ ਦਿੱਤਾ ਹੈ